ਪੰਜਾਬ ਦੇ ਇਤਿਹਾਸ ਲਈ ਤਾਂ ਲਗਭਗ ਸਭ ਜਣੇ ਜਾਣੂ ਹਨ ਪੰਜਾਬ ਦੀ ਵੰਡ ਚਾਰ ਵਾਰ ਹੋਈ ਉੱਨੀ ਸੌ ਇੱਕ ਦੇ ਵਿੱਚ ਵੀ ਹੋਈ ਉੱਨੀ ਸੌ ਗਿਆਰ੍ਹਾਂ ਦੇ ਵਿੱਚ ਉੱਨੀ ਸੌ ਸੰਤਾਲੀ ਦੇ ਵਿੱਚ ਹੋਈ ਅਤੇ ਉੱਨੀ ਸੌ ਛਿਆਹਠ ਦੇ ਵਿੱਚ ਹੋਈ ਜਿਹੜੀ ਉੱਨੀ ਸੌ ਇੱਕ ਦੀ ਵੰਡ ਹੋਈ ਸੀ ਅਤੇ ਉੱਨੀ ਸੌ ਗਿਆਰ੍ਹਾਂ ਉੱਨੀ ਸੌ ਸੰਤਾਲੀ ਉੱਨੀ ਸੌ ਛਿਆਹਠ ਜਿਹੜੀ ਉੱਨੀ ਸੌ ਇੱਕ ਦੀ ਵੰਡ ਹੋਈ ਸੀ ਉਹ ਲੋਡ ਕਰਜਨ ਫੋਰੋ ਵਾਈਸਰਾਏ ਸੀ ਉਹਨਾਂ ਦੇ ਦੌਰਾਨ ਹੋਈ ਦੋ ਉੱਨੀ ਸੌ ਗਿਆਰ੍ਹਾਂ ਵਾਲੀ ਵੰਡ ਜਿਹੜੀ ਲੋਰਡ ਹਾਰਜ਼ਿਗ ਹਾਰਡਿੰਗ ਦੇ ਟਾਈਮ ਹੋਈ ਜਦੋਂ ਕਿ ਦਿੱਲੀ ਨੂੰ ਇੱਕ ਅੱਡ ਹਿੱਸਾ ਪੰਜਾਬ ਤੋਂ ਕਰਕੇ ਦੇਸ਼ ਦੀ ਰਾਜਧਾਨੀ ਨੂੰ ਘੋਸ਼ਿਤ ਕਰ ਦਿੱਤਾ ਗਿਆ ਸੀ ਫਿਰ ਉੱਨੀ ਸੌ ਸੰਤਾਲੀ ਦੀ ਵੰਡ ਹੋਈ ਜਿਸ ਵਿੱਚ ਕੁੱਲ ਉਨੱਤੀ ਜ਼ਿਲ੍ਹੇ ਸੀ ਉਹਨਾਂ ਵਿੱਚੋਂ ਸੌਲ੍ਹਾਂ ਜ਼ਿਲ੍ਹੇ ਤਾਂ ਪਾਕਿਸਤਾਨ ਚਲੇ ਗਏ ਤੇਰ੍ਹਾਂ ਜ਼ਿਲ੍ਹੇ ਪੰਜਾਬ 'ਚ ਰਹਿ ਗਏ ਪੰਜ ਡਿਵੀਜ਼ਨਾਂ ਸੀ ਤਿੰਨ ਪਾਕਿਸਤਾਨ ਚਲੀਆਂ ਗਈਆਂ ਦੋ ਪੰਜਾਬ ਵਾਲੀ ਸਾਈਡ ਆ ਗਈਆਂ ਜਿਹੜੀ ਪੰਜਾਬ ਵਾਲੀ ਸਾਈਡ ਹੈਗੀਆਂ ਉਹ ਇੱਕ ਜਲੰਧਰ ਡਿਵੀਜ਼ਨ ਸੀ ਇੱਕ ਦਿੱਲੀ ਡਿਵੀਜ਼ਨ ਸੀ ਜ਼ਿਲ੍ਹੇ ਤੇਰ੍ਹਾਂ ਜ਼ਿਲ੍ਹੇ ਆਏ ਜਿਹਨਾਂ ਵਿੱਚ ਹਰਿਆਣੇ ਦੇ ਵੀ ਸੀ ਚਾਰ ਪੰਜ ਅਤੇ ਛੇ ਜ਼ਿਲ੍ਹੇ ਪੰਜਾਬ ਦੇ ਸੀ ਅਤੇ ਦੋ ਜ਼ਿਲ੍ਹੇ ਤੁਸੀਂ ਮੰਨ ਲਉ ਹਿਮਾਚਲ ਪ੍ਰਦੇਸ਼ ਦੇ ਸੀ ਕਾਂਗੜਾ ਸੀ ਅਤੇ ਇੱਕ ਸ਼ਿਮਲਾ ਸੀ ਹਿਮਾਚਲ ਪ੍ਰਦੇਸ਼ ਦਾ ਸੋ ਹਰਿਆਣੇ ਦੇ ਵਿੱਚ ਅੰਬਾਲਾ ਰੋਹਤਕ ਕਰਨਾਲ ਹਿਸਾਰ ਜੀਂਦ ਇਹ ਆਏ ਅਤੇ ਪੰਜਾਬ ਦੇ ਵਿੱਚ ਫਿਰੋਜ਼ਪੁਰ ਲੁਧਿਆਣਾ ਅੰਮ੍ਰਿਤਸਰ ਤਰਨ ਤਾਰਨ ਹੁਸ਼ਿਆਰਪੁਰ ਇਸ ਪ੍ਰਕਾਰ ਦੇ ਜਿਹੜੇ ਜ਼ਿਲ੍ਹੇ ਦੇਖਣ ਨੂੰ ਮਿਲੇ ਇਸ ਦੇ ਲਈ ਇਸ ਤੋਂ ਬਾਅਦ ਉੱਨੀ ਸੌ ਛਿਆਹਠ ਦੇ ਵਿੱਚ ਪੰਜਾਬ ਇੱਕ ਅੱਡ ਸੂਬਾ ਇੱਕ ਤਰ੍ਹਾਂ ਨਾਲ ਹਿਮਾਚਲ ਤੋਂ ਅਤੇ ਹਰਿਆਣੇ ਤੋਂ ਅਲੱਗ ਹੋ ਗਿਆ ਇੱਕ ਨਵੰਬਰ ਉੱਨੀ ਸੌ ਛਿਆਹਠ ਨੂੰ ਇਹ ਅਲੱਗ ਹੋ ਗਿਆ ਸੀ ਪੰਜਾਬ ਖੇਤਰ 'ਤੇ ਬਹੁਤ ਪ੍ਰਭਾਵ ਪਿਆ ਹੈ ਜੋ ਵੀ ਵੰਡ ਹੋਈ ਹੈ ਜਿਵੇਂ ਪਾਕਿਸਤਾਨ ਤੋਂ ਸਮਝੌਤਾ ਐਕਸਪ੍ਰੈਸ ਬੰਦ ਕੀਤੀ ਗਈ ਪਾਕਿਸਤਾਨ ਨਾਲ ਜੋ ਵੀ ਵਪਾਰ ਸੀ ਉਹ ਖਤਮ ਹੋਇਆ ਗਿਆ ਅਤੇ ਬਾਰਡਰ ਦ ਰੇਂਜ ਦੀਆਂ ਜਿੰਨੀਆਂ ਪ੍ਰੋਬਲਮ ਪੰਜਾਬ ਨੂੰ ਬਹੁਤ ਫੇਸ ਕਰਨੀਆਂ ਪੈਂਦੀਆਂ ਹਨ ਕਿਉਂਕਿ ਮੇਜਰ ਇੰਨ ਐਕਸਟਰਨਲ ਇਸ਼ੂਜ਼ ਜਿਹੜੇ ਸਕਿਉਰਟੀ ਦੇ ਉਹ ਪਾਕਿਸਤਾਨ ਵੱਲੋਂ ਪੰਜਾਬ ਦੇ ਥਰੂ ਹੀ ਹੁੰਦੇ ਹਨ ਜਿਵੇਂ ਕਿ ਆਪਾਂ ਦੇਖਿਆ ਸੀ ਤਿੰਨ ਸਾਲ ਪਹਿਲਾਂ ਦੋ ਹਜ਼ਾਰ ਸੌਲ੍ਹਾਂ ਦੇ ਵਿੱਚ ਦੀਨਾ ਨਗਰ ਅਟੈਕਰ ਹੋਇਆ ਸੀ ਉਹ ਵੀ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਹੈ ਪੰਜਾਬ ਨੂੰ ਹੀ ਫੇਸ ਕਰਨਾ ਪਿਆ ਸੋ ਇਸ ਤਰੀਕੇ ਨਾਲ ਬਹੁਤ ਸਮੱਸਿਆਵਾਂ ਪੰਜਾਬ ਨੂੰ ਕਰਨੀਆਂ ਪਈਆਂ